ਪਟਿਆਲਾ ਜ਼ਿਲ੍ਹਾ ਅੱਜ ਕੱਲ੍ਹ ਇੱਕ ਸ਼ਹਿਰੀ ਸਥਾਨ ਬਣ ਚੁੱਕਾ ਹੈ ਪਰ ਇੱਥੇ ਅਜੇ ਵੀ ਖੇਤੀਬਾੜੀ ਬਹੁਤ ਸਥਾਨਾਂ 'ਤੇ ਕੀਤੀ ਜਾਂਦੀ ਹੈ ਜਿੱਦਾਂ ਕਿ ਮਹਿੰਦਰਾ ਕੋਲਜ ਕੋਲ ਸੋਲਰ ਰੋਡ ਉੱਤੇ ਕਾਫੀ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਸਾਰਾ ਸਾਲ ਹੀ ਖੇਤੀ ਚੱਲਦੀ ਹੈ ਇੱਥੇ ਜੀਰੀ ਅਤੇ ਕਣਕ ਵੀ ਉਗਾਈ ਜਾਂਦੀ ਹੈ ਖੇਤੀਬਾੜੀ ਅੱਜ ਕੱਲ੍ਹ ਵੀ ਬਹੁਤ ਲੋਕ ਕਰਦੇ ਹਨ ਅਤੇ ਉਹ ਟਰੈਕਟਰ ਕੰਬਾਇਨਾਂ ਵਰਗੇ ਨਵੀਂ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹਨ ਕਾਫੀ ਮੁੱਖ ਪੱਧਰ 'ਤੇ ਖੇਤੀਬਾੜੀ ਕੀਤੀ ਜਾਂਦੀ ਹੈ ਪਾਣੀ ਲਾਉਣ ਵਾਸਤੇ ਵੀ ਖੇਤਾਂ ਵਿੱਚ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਨਾਲ ਸਾਰਾ ਖੇਤ ਕਵਰ ਕੀਤਾ ਜਾ ਸਕੇ ਲੋਕਾਂ ਨੇ ਅਜੇ ਵੀ ਘਰਾਂ ਵਿੱਚ ਪਸ਼ੂ ਰੱਖੇ ਹੋਏ ਹਨ ਜਿਨ੍ਹਾਂ ਤੋਂ ਉਹ ਦੁੱਧ ਦਹੀਂ ਗੋਹਾ ਅਤੇ ਪਾਥੀਆਂ ਵਰਗੀ ਚੀਜ਼ਾਂ ਮਿਲਦੀਆਂ ਹਨ ਅਤੇ ਉਹਨਾਂ ਦਾ ਉਹ ਇਸਤੇਮਾਲ ਕਰਦੇ ਹਨ